ਹਾਂ ਮੈਂ ਆਪਣੇ ਇੰਟਰਨੈਟ ਕਨੈਕਸ਼ਨ ਨੂੰ ਸੁਰੱਖਿਅਤ ਕਰਨ ਜਾਂ ਆਪਣੀ ਆਨਲਾਈਨ ਗੋਪਨੀਅਤਾ ਨੂੰ ਦੀ ਰੱਖਿਆ ਕਰਨ ਲਈ ਬਹੁਤ ਵਾਰ ਵਰਚੁਅਲ ਪ੍ਰਾਈਵੇਟ ਨੈਟਵਰਕ ਦੀ ਵਰਤੋਂ ਕੀਤੀ ਹੈ ਵਰਚੁਅਲ ਪ੍ਰਾਈਵੇਟ ਨੈਟਵਰਕ ਹੁੰਦਾ ਕੀ ਹੈ ਵਰਚੁਅਲ ਪ੍ਰਾਈਵੇਟ ਨੈਟਵਰਕ ਕੀ ਕਰਦਾ ਹੈ ਤੁਹਾਡਾ ਜਿਹੜਾ ਵੀ ਤੁਹਾਡੇ ਕੰਪਿਊਟਰ ਦਾ ਤੁਹਾਡੇ ਫੋਨ ਦਾ ਜੋ ਵੀ ਆਈਪੀ ਐਡਰੈਸ ਹੁੰਦਾ ਉਸ ਆਈਪੀ ਐਡਰੈਸ ਨੂੰ ਮਾਸਕ ਕਰ ਦਿੰਦਾ ਜਿਸ ਦਾ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਤੁਹਾਡਾ ਆਈਪੀ ਐਡਰੈਸ ਜਿਹੜਾ ਉਹਨੂੰ ਲਕੋ ਦਿੰਦਾ ਤਾਂ ਕਿ ਕੋਈ ਵੀ ਜਿਹੜਾ ਬਾਹਰਲਾ ਬੰਦਾ ਜਿਹਨੂੰ ਆਪਾਂ ਹੈਕਰ ਕਹਿੰਦੇ ਹਾਂ ਉਹ ਇਸ ਨੂੰ ਯੂਜ ਕਰਕੇ ਤੁਹਾਡਾ ਇੰਟਰਨੈਟ ਕਨੈਕਸ਼ਨ ਹੈਕ ਨਾ ਕਰ ਲਵੇ ਜਾਂ ਤੁਹਾਡੀ ਆਨਲਾਈਨ ਗੋਪ ਗੋਪਨੀਅਤਾ ਨੂੰ ਦੀ ਰੱਖਿਆ ਕਰਨ ਵਿੱਚ ਤੁਹਾਨੂੰ ਜੋ ਵੀ ਤੁਹਾਡੀ ਆਨਲਾਈਨ ਟ੍ਰਾਂਜੈਕਸ਼ਨਸ ਹੈ ਤੁਸੀਂ ਕਰਦੇ ਹੋ ਉਹ ਸਾਰਾ ਤੁਹਾਡਾ ਡਾਟਾ ਆਪਣੇ ਕੋਲ ਨਾ ਰੱਖੇ ਇਸ ਕਰਕੇ ਵਰਚੁਅਲ ਪ੍ਰਾਈਵੇਟ ਨੈਟਵਰਕ ਇਸ ਤੋਂ ਤੁਹਾਨੂੰ ਬਚਾਉਂਦਾ ਹੈ ਉਹ ਕਰਦਾ ਕੀ ਹੈ ਉਹ ਟੈਕਨੋਲੋਜੀ ਯੂਜ ਕਰਦਾ ਹੈ ਡੇਟਾ ਐਨਕ੍ਰਿਪਸ਼ਨ ਦੀ ਇਨਕ੍ਰਿਪਸ਼ਨ ਕੀ ਹੁੰਦੀ ਹੈ ਕਿ ਜੋ ਵੀ ਤੁਹਾਡਾ ਆਪਣਾ ਡੇਟਾ ਹੈ ਤੁਹਾਡਾ ਕੋਈ ਵੀ ਡਿਟੇਲਸ ਹੈ ਤੁਹਾਡਾ ਅਕਾਊਂਟ ਨੰਬਰ ਹੈ ਉਸ ਸਭ ਨੂੰ ਉਹ ਮਾਸਕ ਕਰ ਦਿੰਦਾ ਤਾਂ ਇਸ ਤਰ੍ਹਾਂ ਮੇਰਾ ਅਨੁਭਵ ਤਾਂ ਇਸ ਲਈ ਇਸ ਨਾਲ ਬਹੁਤ ਹੀ ਜ਼ਿਆਦਾ ਵਧੀਆ ਸਭ ਨੂੰ ਵਰਚੁਅਲ ਪ੍ਰਾਈਵੇਟ ਨੈਟਵਰਕ ਯੂਜ ਕਰਨਾ ਚਾਹੀਦਾ ਹੈ